ਦਿਵਾਲੀ ਦੇ ਤਿਉਹਾਰ 'ਤੇ ਰੰਗ ਬਿਰੰਗੇ ਰੰਗਾਂ ਨਾਲ ਰੰਗੋਲੀ ਬਣਾਈ ਜਾਂਦੀ ਹੈ ਇਹ ਖੁਸ਼ੀ ਦਾ ਪ੍ਰਤੀਕ ਹੁੰਦੀ ਰੰਗੋਲੀ ਦੇ ਨਾਲ ਬਹੁਤ ਵਧੀਆ ਵਧੀਆ ਡਿਜ਼ਾਇਨ ਬਣਾਏ ਜਾਂਦੇ ਹਨ ਸੂਰਜ ਨੂੰ ਪਾਣੀ ਹਿੰਦੂ ਧਰਮ ਵਿੱਚ ਦਿੱਤਾ ਜਾਂਦਾ ਹੈ ਇਹ ਪਾਣੀ ਆਪਣੇ ਵੱਡੇ ਵਡੇਰਿਆਂ ਨੂੰ ਦਿੱਤਾ ਜਾਂਦਾ ਹੈ ਪਰ ਇਸ ਰੀਤ ਦਾ ਗੁਰੂ ਨਾਨਕ ਦੇਵ ਜੀ ਨੇ ਵਿਰੋਧ ਵੀ ਕੀਤਾ ਸੀ ਮੱਥੇ 'ਤੇ ਸੰਦੂਰ ਹਿੰਦੂ ਧਰਮ ਵਿੱਚ ਸੁਹਾਗਣਾਂ ਲਗਾਉਂਦੀਆਂ ਹਨ ਮੱਥੇ 'ਤੇ ਸੰਧੂਰ ਭਰਨ ਨੂੰ ਉਹਨਾਂ ਦੇ ਧਰਮ ਵਿੱਚ ਸ਼ੁੱਭ ਮੰਨਿਆ ਜਾਂਦਾ ਹੈ ਪਵਿੱਤਰ ਧਾਗਾ ਲੋਕ ਆਪਣੇ ਗੁੱਟ 'ਤੇ ਜਾਂ ਪੈਰਾਂ 'ਤੇ ਬੰਨ੍ਹਦੇ ਹਨ ਇਹ ਧਾਗਾ ਨਜ਼ਰ ਲੱਗਣ ਤੋਂ ਬਚਣ ਲਈ ਬੰਨਿਆ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਕੋਈ ਬੁਰੀ ਨਜ਼ਰ ਨਾ ਲੱਗੇ ਲੋਕ ਹਿੰਦੂ ਧਰਮ ਵਿੱਚ ਮੰਦਰਾਂ ਵਿੱਚ ਪੂਜਾ ਕਰਨ ਜਾਂਦੇ ਹਨ ਉਹ ਹਿੰਦੂ ਧਰਮ 'ਚ ਦੇਵੀ ਦੇਵਤਿਆਂ ਨੂੰ ਜ਼ਿਆਦਾ ਮੰਨਦੇ ਹਨ ਮੁਸਲਮਾਨ ਭਾਈਚਾਰੇ ਵਿੱਚ ਲੋਕ ਦਰਗਾਹ ਵਿੱਚ ਨਮਾਜ਼ ਪੜ੍ਹਨ ਜਾਂਦੇ ਹਨ ਅਤੇ ਉਹਨਾਂ ਦੁਆਰਾ ਰੋਜੇ ਰੱਖੇ ਜਾਂਦੇ ਹਨ ਅਤੇ ਵਰਤ ਰੱਖੇ ਜਾਂਦੇ ਹਨ ਇਹਨਾਂ ਸਾਰੀਆਂ ਰੀਤਾਂ ਦਾ ਹਿੰਦੂ ਧਰਮ ਵਿੱਚ ਬਹੁਤ ਮਹੱਤਵ ਹੈ ਪਰ ਸਾਡੇ ਧਰਮ ਵਿੱਚ ਇਹਨਾਂ ਰੀਤਾਂ ਦਾ ਕੋਈ ਮਤਲਬ ਨਹੀਂ ਹੈ ਸਾਨੂੰ ਸਾਡੇ ਧਰਮਾਂ ਸਾਨੂੰ ਸਾਡੇ ਧਰਮ ਵਿੱਚ ਗੁਰਬਾਣੀ ਕੀਰਤਨ ਵਾਲੇ ਪਾਸੇ ਲਾਇਆ ਹੋਇਆ ਕਿਉਂਕਿ ਅਸੀਂ ਸਿੱਖ ਧਰਮ ਵਿੱਚੋਂ ਹਾਂ